ਸਟੈਂਪ ਸਿੱਕਿਆਂ ਨੂੰ ਇਕੱਠਾ ਕਰਨ ਦਾ ਬਹੁਤ ਜ਼ਿਆਦਾ ਮੁੱਲ ਹੈ ਜਿਵੇਂ ਕਿ ਸਾਡੀ ਪੁਰਾਣੀ ਵਿਰਾਸਤ ਦੇ ਵਿੱਚ ਸਾਡੇ ਬਜ਼ੁਰਗ ਉਹ ਉਸ ਸਮੇਂ ਦੇ ਸਿੱਕੇ ਅਤੇ ਸਟੈਂਪ ਕੀ ਕੀ ਸਨ ਉਸ ਸਮੇਂ ਕਿਸ ਚੀਜ਼ ਦੀ ਵਰਤੋਂ ਕਰਦੇ ਸਨ ਇਹ ਸਾਰੇ ਸਟੈਂਪ ਅਤੇ ਸਿੱਕਿਆਂ ਨੂੰ ਸਾਨੂੰ ਇਕੱਠਾ ਕਰਨਾ ਚਾਹੀਦਾ ਅਤੇ ਉਹ ਕੀ ਵਰਤਦੇ ਸਨ ਇਹ ਸਟੈਂਪ ਅਤੇ ਸਿੱਕੇ ਚੱਲਦੇ ਸਨ ਜਿਸ ਦੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਸਟੈਂਪ ਅਤੇ ਸਿੱਕਿਆਂ ਬਾਰੇ